ਮੇਰੇ ਫੋਨ ਵਿੱਚ ਬਹੁਤ ਸਾਰੇ ਕਈ ਲਾਈਵ ਐਪ ਹਨ ਅਤੇ ਮੈਂ ਉਸ ਉੱਪਰ ਬਹੁਤ ਸਾਰੀਆਂ ਗੇਮਾਂ ਦੇਖਦਾ ਹਾਂ ਜਿਵੇਂ ਫੁੱਟਬਾਲ ਕ੍ਰਿਕਟ ਆਦਿ ਆਦਿ ਵੇਖ ਸਕਦਾ ਹਾਂ ਜੇਕਰ ਮੈਂ ਜੇਕਰ ਮੈਂ ਕੋਈ ਵੀ ਲਾਈਵ ਐਪ ਵੇਖਣਾ ਹੋਵੇ ਤਾਂ ਮੈਨੂੰ ਇਸ ਪਰ ਸੌਖਾ ਰਹਿੰਦਾ ਹੈ ਮੈਨੂੰ ਐਲ ਸੀ ਐਲ ਈ ਡੀ ਵੋਲ ਉੱਤੇ ਬਹੁਤ ਔਖਾ ਲੱਗਦਾ ਹੈ ਮੈਂ ਇਸ ਉੱਪਰ ਇਸ ਉੱਪਰ ਮੈਂ ਸਰਚਿੰਗ ਕਰਕੇ ਕੱਢ ਸਕਦਾ ਹਾਂ ਅਤੇ ਇਹ ਐਲ ਈ ਡੀ ਵੋਲ ਉੱਤੇ ਮੈਨੂੰ ਚੈਨਲ ਲੱਭਣਾ ਪੈਂਦਾ ਹੈ ਅਤੇ ਮੈਂ ਆਪ ਵੀ ਖਿਡਾਰੀ ਹਾਂ ਮੈਨੂੰ ਫੁੱਟ ਅ ਮੈਨੂੰ ਕ੍ਰਿਕਟ ਬਹੁਤ ਜ਼ਿਆਦਾ ਹੀ ਪਸੰਦ ਹੈ ਇਸ ਲਈ ਮੈਂ ਕ੍ਰਿਕਟ ਲਾਈਵ ਕੱਢ ਲੈਂਦਾ ਹਾਂ ਜਦੇ ਹੀ ਅਤੇ ਮੈਨੂੰ ਟੀ ਵੀ ਉੱਤੇ ਬਹੁਤ ਜ਼ਿਆਦਾ ਹੀ ਔਖਾ ਲੱਗਦਾ ਹੈ ਅਤੇ ਮੈਨੂੰ ਟੀ ਵੀ ਉੱਤੇ ਬਹੁਤ ਜ਼ਿਆਦਾ ਔਖਾ ਲੱਗਦਾ ਹੈ ਅਤੇ ਮੈਂ ਇਸ ਉੱਪਰ ਲਾਈਵ ਕੱਢ ਕੇ ਵੇਖ ਲੈਂਦਾ ਜੇਕਰ ਮੈਂ ਸਕੋਰ ਵੇਖਣੇ ਹੁੰਦੇ ਤਾਂ ਮੈਂ ਝੱਟ ਪੱਟ ਹੀ ਕੱਢ ਕੇ ਵੇਖ ਲੈਂਦਾ ਹਾਂ